ਇੱਥੇ ਮਛੇਰਿਆਂ ਦੀਆਂ ਕਾਫ਼ੀ ਜਾਤਾਂ ਪਾਈਆਂ ਜਾਂਦੀਆਂ ਸੀ ਉਹਨਾਂ ਵਿੱਚੋਂ ਕੁਝ ਕੁ ਤਾਂ ਅਲੋਪ ਹੋ ਚੁੱਕੀਆਂ ਵਾ ਫਿਰ ਵੀ ਦੋ ਕੁ ਜਾਤਾਂ ਜਿਹੜੀਆਂ ਮੈਂ ਦੱਸ ਰਿਹਾ ਹਾਂ ਉਹ ਹੈਗੀਆਂ ਝਿਊਰ ਜਾਤੀ ਅਤੇ ਮਹਿਰੇ ਇਹ ਮੱਛੀ ਫੜਨ ਦਾ ਮੱਛੀ ਪਾਲਣ ਦਾ ਕੰਮ ਕਰਦੇ ਨੇ ਅਤੇ ਇਕ ਜੇ ਸਮਾਜ ਦੀ ਗੱਲ ਕਰੀਏ ਤਾਂ ਇਹ ਅਸੀਂ ਸਾਰੇ ਕ ਇਕੱਠੇ ਇੱਕ ਸਮਾਜ ਦੇ ਵਿੱਚ ਰਲ ਮਿਲ ਕੇ ਸਾਰੀਆਂ ਜਾਤਾਂ ਦੇ ਲੋਕ ਰਹਿੰਦੇ ਹਨ ਸਾਰੇ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਇੱਕ ਦੂਜੇ ਤੇ ਸੁੱਖ ਦੁੱਖ ਵਿੱਚ ਭਾਈ ਵਾਲ ਹੁੰਦੇ ਹਨ ਅਤੇ ਜੇ ਗੱਲ ਕਰੀਏ ਤਿਉਹਾਰਾਂ ਦੀ ਤਾਂ ਤਿਉਹਾਰ ਸਾਰੇ ਹੀ ਰਲ ਮਿਲ ਕੇ ਸਾਂਝੇ ਤੌਰ 'ਤੇ ਮਨਾਏ ਜਾਂਦੇ ਹਨ ਜਿਵੇਂ ਕਿ ਲੋਹੜੀ ਦਿਵਾਲੀ ਵਿਸਾਖੀ ਇਹਨਾਂ ਸਾਰਿਆਂ ਤਿਉਹਾਰਾਂ ਦੇ ਉੱਤੇ ਇੱਕ ਦੂਜੇ ਨੂੰ ਮੁਬਾਰਕ ਕਹੀ ਜਾਂਦੀ ਹੈ ਅਤੇ ਇੱਕ ਦੂਜੇ ਨੂੰ ਤੋਹਫੇ ਵੀ ਦਿੱਤੇ ਜਾਂਦੇ ਹਨ ਕੁਝ ਗੁਰੂਆਂ ਦੇ ਗੁਰਪੁਰਬ ਜਿਸ ਤਰ੍ਹਾਂ ਮਨਾਏ ਜਾਂਦੇ ਹਨ ਉਹ ਵੀ ਸਾਰੇ ਰਲ ਮਿਲ ਕੇ ਸਾਰੀਆਂ ਜਾਤਾਂ ਦੇ ਸਾਰਿਆਂ ਧਰਮਾਂ ਦੇ ਲੋਕ ਰਲ ਮਿਲ ਕੇ ਹੀ ਮਨਾਉਂਦੇ ਹਨ